ਅੱਜ ਕੱਲ ਡਾਂਸ ਦੇ ਖੇਤਰ ਦੇ ਵਿੱਚ ਔਰਤਾਂ ਨੂੰ ਘੱਟ ਹੀ ਵੇਖਿਆ ਜਾਂਦਾ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੜਕਿਆਂ ਨੂੰ ਡਾਂਸ ਕਰਨ ਦੀ ਘਰਦਿਆਂ ਵੱਲੋਂ ਹੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਉਂਕੀ ਜੇਕਰ ਕੋਈ ਲੜਕੀ ਡਾਂਸ ਕਰਦੀ ਹੈ ਤਾਂ ਉਸਨੂੰ ਸਮਾਜ ਦੇ ਵਿੱਚ ਅਜਿਹਾ ਰੁਤਬਾ ਪ੍ਰਦਾਨ ਨਹੀਂ ਹੁੰਦਾ ਰੁਤਬਾ ਦਿੱਤਾ ਨਹੀਂ ਜਾਂਦਾ ਇਸ ਲਈ ਕਿਆ ਹੈ ਕਿ ਜੋ ਜੋ ਡਾਂਸ ਹ ਮਤਲਬ ਘਰਦੇ ਆ ਉਹ ਲੜਕਿਆਂ ਨੂੰ ਡਾਂਸ ਕਰਨ ਨਹੀਂ ਦਿੰਦੇ ਇਹ ਮਤਲਬ ਅੱਜ ਕੱਲ ਜੇ ਦੇਖਿਆ ਜਾਏ ਜਿਵੇਂ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜੀਆਂ ਕਿ ਮਤਲਬ ਲੜਕੀਆਂ ਡਾਂਸ ਕਰਦੀਆਂ ਹਨ ਔਰ ਕੈਸਟਰਾ ਵਾਲੀਆਂ ਉਹਨਾਂ ਨੂੰ ਵੀ ਦੇਖ ਲਿਆ ਜਾਵੇ ਉਹਨਾਂ ਨਾਲ ਵੀ ਕਿਹਾ ਜਿਹਾ ਵਤੀਰਾ ਕੀਤਾ ਜਾਂਦਾ ਹੈ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਜਦੋਂ ਕਿ ਉਹ ਉਹਨਾਂ ਦਾ ਮਤਲਬ ਡਾਂਸ ਕਰਨਾ ਕੋਈ ਮਤਲਬ ਸ਼ੌਂਕ ਨਹੀਂ ਹੁੰਦਾ ਉਹ ਕਈਆਂ ਕੁੜੀਆਂ ਹੁੰਦੀਆਂ ਜਿਹਨਾਂ ਨੂੰ ਸ਼ੋਂਕ ਹੁੰਦਾ ਏ ਪਰ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਹੈ ਪਰ ਉਹਨਾਂ ਦੀ ਮਜਬੂਰੀ ਨੂੰ ਸਮਝਿਆ ਨਹੀਂ ਜਾਂਦਾ ਤੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਚਰਿੱਤਰਹੀਣ ਸਮਝਿਆ ਜਾਂਦਾ ਉਹਨਾਂ ਦੇ ਲਈ ਅਜਿਹੇ ਅਜਿਹੇ ਮਤਲਬ ਸ਼ਬਦ ਯੂਜ ਕੀਤੇ ਜਾਂਦੇ ਹਨ ਇਸ ਲਈ ਕਿਆ ਹੈ ਜੋ ਸਾਡਾ ਸਮਾਜ ਹ ਇਸਦੇ ਵਿੱਚ ਮਤਲਬ ਜਿਹੜੀਆਂ ਔਰਤਾਂ ਇਹਨਾਂ ਨੂੰ ਡਾਂਸ ਦੇ ਲਈ ਮਤਲਬ ਵਧੀਆ ਸਥਾਨ ਨਹੀਂ ਪ੍ਰਾਪਤ ਹੈ ਜਿਹੜੀਆਂ ਔਰਤਾਂ ਜੋ ਕੁੜੀਆਂ ਹ ਉਹ ਸ਼ੌਂਕ ਦੇ ਤੌਰ ਤੇ ਵੀ ਡਾਂਸ ਕਰਦੀਆਂ ਹਨ ਉਹਨਾਂ ਨੂੰ ਵੀ ਅਜਿਹੀਆਂ ਅਜਿਹੀਆਂ ਗੱਲਾਂ ਬੋਲੀਆਂ ਜਾਂਦੀਆਂ ਹਨ ਅਜਿਹੀਆਂ ਅਜਿਹੀਆਂ ਗੱਲਾਂ ਬੋਲੀਆਂ ਜਾਂਦੀਆਂ ਕਿ ਉਹ ਮਤਲਬ ਡਾਂਸ ਕਰਨੇ ਤੋਂ ਪਰਹੇਜ ਕਰਦੀਆਂ ਹਨ ਔਰ ਜਿਹੜੀਆਂ ਕੁੜੀਆਂ ਮਤਲਬ ਜਿਦਾਂ ਕਿ ਕਿਸੇ ਵੀ ਕੁੜੀ ਨੇ ਕਿਸੇ ਔਰਤ ਨੇ ਅਕੈਡਮੀ ਖੋਲੀ ਹੋਵੇ ਅਕੈਡਮੀ ਚ ਮਤਲਬ ਡਾਂਸ ਸਿਖਾਂਦੀ ਹੋਵੇ ਡਾਂਸ ਸਟੈਪਸ ਸਿਖਾਉਂਦੀ ਹੋਵੇ ਇਹ ਸਾਡੇ ਸਮਾਜ ਵਿੱਚ ਅਜਿਹੀ ਔਰਤ ਨੂੰ ਮਤਲਬ ਗਲਤ ਬੋਲਿਆ ਜਾਂਦਾ ਹੈ ਕਿ ਵਧੀਆ ਨਹੀਂ ਹ ਇਸ ਲਈ ਮਤਲਬ ਕਿਆ ਜੋ ਵੀ ਲੜਕੀਆਂ ਦੇ ਘਰ ਦੇ ਹ ਉਹੀ ਪਹਿਲਾਂ ਉਹਨਾਂ ਨੂੰ ਮਨਾ ਕਰ ਦਿੰਦੇ ਹਨ ਕਿ ਡਾਂਸ ਨਹੀਂ ਕਰਨਾ ਹੈ ਕਿਉਂਕਿ ਜਦ ਸਮਾਜ ਕਿਉਂਕਿ ਜੋ ਵੀ ਹੈ ਜੋ ਵੀ ਜੋ ਵੀ ਹੈ ਸਾਡਾ ਸਭ ਕੁਝ ਚੱਲਦਾ ਹ ਇਹ ਸਮਾਜ ਦੇ ਅਕੋਰਡਿੰਗ ਹੀ ਚੱਲਦਾ ਹ ਸਮਾਜ ਜਿਵੇਂ ਕਹਿੰਦਾ ਉਹ ਵੀ ਚੱਲਦਾ ਹ ਕਿਉਂਕੀ ਮਤਲਬ ਸਾਡੇ ਸਮਾਜ ਦੇ ਵਿੱਚ ਅਜਿਹਾ ਹੁੰਦਾ ਹੈ ਕਿ ਜੋ ਲੋਕ ਕਹਿੰਦੇ ਹਨ ਲੋਕ ਜੋ ਬੋਲਦੇ ਹਨ ਮਤਲਬ ਉਹ ਅੱਜ ਕੱਲ ਬਹੁਤ ਜਿਆਦਾ ਮਾਇਨੇ ਰੱਖਦਾ ਹ ਇਸ ਦੇ ਲਈ ਮਤਲਬ ਕਿਆ ਹ ਲੋਕਾਂ ਨੂੰ ਡਾਂਸ ਮਤਲਬ ਕਿਆ ਇਹ ਵਧੀਆ ਮਤਲਬ ਜੋ ਹ ਸਮਝਿਆ ਨਹੀਂ ਜਾਂਦਾ ਇਸ ਲਈ ਕਿਹਾ ਔਰਤਾਂ ਜਿਹੜੀਆਂ ਹੈਗੀਆਂ ਉਹ ਡਾਂਸ ਕਰਨ ਤੋਂ ਪਰਹੇਜ਼ ਕਰਦੇ ਹਨ ਡਾਂਸ ਕਰਨ ਵਾਲੀਆਂ ਔਰਤਾਂ ਨੂੰ ਡਾਂਸਰਾਂ ਨੂੰ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਜਿਹਦੇ ਕਿ ਵਿਆਹਾਂ ਦੇ ਵਿੱਚ ਆਰਕੈਸਟਰਾ ਨਾਲ ਦੇ ਨਾਲ ਮਤਲਬ ਬਹੁਤ ਸਾਰਾ ਅਜਿਹਾ ਬੁਰਾ ਵਤੀਰਾ ਕੀਤਾ ਜਾਂਦਾ ਇਸ ਲਈ ਕਿਹਾ ਹ ਇਹ ਕੁੜੀਆਂ ਔਰਤਾਂ ਡਾਂਸ ਕਰਨ ਤੋਂ ਪਰਹੇਜ਼ ਕਰਦੀਆਂ ਹਨ ਪਰਹੇਜ ਕਰਨਾ ਉਹਨਾਂ ਦੀ ਮਜਬੂਰੀ ਹੁੰਦਾ ਹੈ ਕਿਉਂਕਿ ਉਹ ਲੋਕਾਂ ਤੋਂ ਉਹ ਸਮਾਜ ਤੋਂ ਅਜਿਹੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੀਆਂ ਹਨ ਜੋ ਉਹ ਸੁਣ ਸੁਣ ਰਹੀਆਂ ਹੁੰਦੀਆਂ ਹਨ ਕਿਉਂਕਿ ਲੋਕ ਉਹਨਾਂ ਨੂੰ ਬਹੁਤ ਬੁਰਾ ਭਲਾ ਬੋਲਦੇ ਹਨ ਕੀ ਇਹ ਇੱਦਾਂ ਚਰਿੱਤਰ ਐਵੇਂ ਐਵੇਂ ਐ ਇਸ ਲਈ ਕਿਹਾ ਹ ਔਰਤਾਂ ਜੋ ਵੀ ਹੈ ਮਤਲਬ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਇਸ ਲਈ ਕਿ ਆਓ ਇਹ ਕੰਮ ਕਰਨੇ ਤੋਂ ਪਰਹੇਜ ਕਰਦੀਆਂ ਹਨ ਤੇ ਇਹਦੀ ਜਗ੍ਹਾ ਕੋਈ ਆਪਣਾ ਹੋਰ ਜੋ ਪ੍ਰੋਫੈਸ਼ਨ ਹ ਉਹ ਚੂਜ ਕਰ ਲੈਂਦੀਆਂ ਤੇ ਆਪਣੇ ਸ਼ੌਂਕ ਨੂੰ ਉੱਥੇ ਦੀ ਉੱਥੇ ਹੀ ਦਬਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਕਿਹਾ ਹ ਅੱਗੇ ਮਤਲਬ ਪ੍ਰੈਫਰ ਨਹੀਂ ਕੀਤਾ ਜਾਂਦਾ ਕਿ ਤੁਸੀਂ ਇਹ ਕੰਮ ਕਰੋ ਇਸ ਲਈ ਕਿਹਾ ਹ ਉਹ ਸੋਚਦੀਆਂ ਹਨ ਕਿ ਹਾਂ ਕੁਝ ਕਰਨਾ ਹੀ ਹ ਡਾਂਸ ਕਿਆ ਹ ਡਾਂਸ ਇਸ ਲਈ ਉਹ ਸੋਚ ਰਹਿੰਦੀਆਂ ਆਪਣੇ ਮਨ ਦੇ ਵਿੱਚ ਅਜਿਹਾ ਬਣਾ ਲੈਂਦੇ ਹਨ ਕਿ ਕਿਆ ਡਾਂਸ ਕਿਆ ਹ ਇਸ ਲਈ ਕਿਆ ਏ ਉਹ ਡਾਂਸ ਕਰਦੀਆਂ ਨੀ ਆਪਣਾ ਕੋਈ ਹੋਰ ਪ੍ਰੋਫੈਸ਼ਨ ਐ ਉਹ ਚੂਜ਼ ਕਰ ਲੈਂਦੀਆਂ ਹਨ ਇਸ ਲਈ ਕਿਆ ਹੈ ਜੋ ਡਾਂਸ ਨੂੰ ਜਿਆਦਾ ਮਤਲਬ ਪ੍ਰੈਫਰ ਨਹੀਂ ਹੋਇਆ ਜਾਂਦਾ ਇਸ ਲਈ ਜੋ ਡਾਂਸ ਵਗੈਰਾ ਉਹ ਅੱਜ ਕੱਲ ਜਿਆਦਾਤਰ ਮੁੰਡਿਆਂ ਦੀਆਂ ਈ ਅਕੈਡਮੀਆਂ ਹਨ ਕੁੜੀਆਂ ਨੂੰ ਜਿਆਦਾ ਪ੍ਰੈਫਰੈਂਸ ਨਾ ਹੋਣ ਦੇ ਕਰਕੇ ਅਜਿਹਾ ਹੁੰਦਾ ਹੈ